ਸਾਡੇ ਪਿੰਡ ਜੋਗਾ ਤੋਂ ਲਗਭਗ ਛੱਬੀ ਸਤਾਈ ਕਿਲੋਮੀਟਰ ਦੂਰੀ 'ਤੇ ਸਥਿਤ ਮਾਨਸਾ ਜ਼ਿਲ੍ਹੇ ਵਿੱਚ ਸਾਡੀਆਂ ਨਿੱਜੀ ਲੋੜਾਂ ਲਈ ਕੱਪੜੇ ਦਵਾਈਆਂ ਖਰੀਦਣ ਲਈ ਬਹੁਤ ਘੱਟ ਰੇਟਾਂ 'ਤੇ ਸਮਾਨ ਮਿਲਦਾ ਜਿਵੇਂ ਕਿ ਫਸਲਾਂ ਦੇ ਨਵੇਂ ਨਵੇਂ ਬੀਜ ਖਾਦਾਂ ਨਵੀਂ ਨਵੀਂ ਟੈਕਨੋਲਜੀ ਦੀਆਂ ਤਿਆਰ ਕੀਤੀਆਂ ਗਈਆਂ ਦਵਾਈਆਂ ਆਦਿ ਬਹੁਤ ਸਮਾਨ ਜੋ ਆਪਣੇ ਨਿੱਜੀ ਜ਼ਿੰਦਗੀ ਦਾ ਲੋੜੀਂਦਾ ਹੈ ਉਹ ਬਹੁਤ ਘੱਟ ਰੇਟਾਂ 'ਤੇ ਵੀ ਮਿਲਦਾ ਹੈ ਲਗਭਗ ਸਾਡੇ ਪਿੰਡ ਤੋਂ ਤੀਹ ਪੈਂਤੀ ਕਿਲੋਮੀਟਰ ਦੂਰੀ 'ਤੇ ਸਥਿਤ ਬਰਨਾਲਾ ਰੋਡ ਆਊਟ ਲੈਟ ਜਿਸ ਵਿੱਚ ਆਪਣੇ ਕੱਪੜੇ ਸਮਾਨ ਬੂਟ ਚੱਪਲਾਂ ਸ਼ਰਟਾਂ ਪੈਂਟਾਂ ਨਵੇਂ ਨਵੇਂ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਿਲਦੇ ਹਨ ਜ ਜਿੱਥੇ ਕਿ ਸਾਨੂੰ ਲਗਭਗ ਵੱਡੀ ਜ਼ਿਆਦਾ ਦੂਰੀ ਨਹੀਂ ਤੈਅ ਕਰਨੀ ਪੈਂਦੀ ਬਹੁਤ ਹੀ ਵਾਜਬ ਰੇਟਾਂ 'ਤੇ ਨੇੜੇ ਮਿਲ ਜਾਂਦਾ ਹੈ ਇਹਦੇ ਨਾਲ ਨਾਲ ਸਾਨੂੰ ਬਰਨਾਲਾ ਸ਼ਹਿਰ ਲੱਗਦਾ ਹੈ ਜਿੱਥੇ ਕਿ ਆਪਣੇ ਘਰ ਦੀਆਂ ਲੱਕੜ ਦਾ ਸਮਾਨ ਖਾਦ ਕੱਪੜੇ ਬਿਜਲੀ ਦਾ ਸਮਾਨ ਜ ਪੂਰਾ ਬਹੁਤ ਘੱਟ ਰੇਟਾਂ 'ਤੇ ਮਿਲਦਾ ਇਹਦੇ ਨਾਲ ਨਾਲ ਸਾਨੂੰ ਪੜ੍ਹਾਈ ਲਈ ਨਾਲ ਲੱਗਦੇ ਸ਼ਹਿਰਾਂ ਵਿੱਚ ਸਕੂਲ ਜਿੱਥੇ ਕਿ ਵਧੀਆ ਪੜ੍ਹਾਈ ਪੜ੍ਹਾਈ ਲਈ ਅਮ ਅਧਿਆਪਕ ਮਿਲਦੇ ਹਨ ਇਸ ਦੇ ਨਾਲ ਨਾਲ ਸਾਨੂੰ ਵਿਗਿਆਨ ਦੇ ਲੱਗਦੇ ਗਰੁੱਪਾਂ ਵਿੱਚ ਵੀ ਨੇੜੇ ਸਕੂਲਾਂ ਵਿੱਚ ਦਾਖਲਾ ਮਿਲਦਾ ਹੈ ਜਿੱਥੇ ਕਿ ਸਾਡੇ ਗਰੀਬ ਪਰਿਵਾਰ ਦੇ ਬੱਚਿਆਂ ਲਈ ਪੜ੍ਹਾਈ ਪੜ੍ਹਾਈ ਵਧੀਆ ਪੜ੍ਹਾਈ ਦਾ ਸਿਖਲਾਈ ਪ੍ਰੈਕਟੀਕਲ ਵਗੈਰਾ ਕੀਤੇ ਜਾਂਦੇ ਹਨ ਇਸ ਦੇ ਨਾਲ ਨਾਲ ਸਾਨੂੰ ਵੱਡੇ ਸ਼ਹਿਰਾਂ ਦੀ ਜਾਣ ਦੀ ਬਜਾਏ ਅੰਬਰਸਰ ਲੱਗਦੇ ਸ਼ਹਿਰਾਂ ਵਿੱਚ ਜਾ ਕੇ ਜਿੱਥੇ ਕਿ ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਸਾਡੇ ਮਨ ਦੀਆਂ ਕੁਝ ਇੱਛਾਵਾਂ ਪੂਰੀ ਹੁੰਦੀਆਂ ਨੇ ਇਸਦੀ ਪੂਰਤੀ ਲਈ ਅਸੀਂ ਧਾਰਮਿਕ ਮਿਥੇ ਵਜੋਂ ਜਾਂਦੇ ਹਾਂ ਇਸ ਦੇ ਨਾਲ ਨਾਲ ਅਸੀਂ ਕਈ ਸ਼ਹਿਰਾਂ ਵਿੱਚ ਹੋਰ ਲੋੜੀਂਦਾ ਸਮਾਨ ਖਰੀਦਣ ਲਈ ਵੀ ਜਾਇਆ ਕਰਦੇ ਹਾਂ ਇਸ ਦੇ ਨਾਲ ਨਾਲ ਸਾਨੂੰ ਆਪਣੇ ਖੇਤੀਬਾੜੀ ਦੇ ਸੰਦਾਂ ਦੀ ਖਰੀਦ ਲਈ ਟਰੈਕਟਰ ਦੇ ਸੰਦ ਟਰਾਲੀ ਵਗੈਰਾ ਸਾਈਕਲ ਵਗੈਰਾ ਜੋ ਵੀ ਸਾਡੀ ਨਿੱਜੀ ਜ਼ਿੰਦਗੀ ਦੀਆਂ ਲੋੜੀਂਦੀਆਂ ਚੀਜ਼ਾਂ ਹਨ ਉਹ ਸਾਨੂੰ ਸ਼ਹਿਰ ਵਿੱਚੋਂ ਮਿਲਦੀਆਂ ਹਨ ਜੋ ਕਿ ਬਹੁਤ ਘੱਟ ਰੇਟਾਂ 'ਤੇ ਮਿਲ ਜਾਂਦੀਆਂ ਹਨ ਧੰਨਵਾਦ ਸਹਿਤ